ਸਾਡੇ ਪੰਜਾਬ ਵਿੱਚ ਜਿਹੜੀ ਪੰਜਾਬ ਸਿਹਤ ਟੈਕਨੋਲਜੀ ਹੈ ਉਹ ਬਹੁਤ ਹੀ ਵਧੀਆ ਕੰਮ ਕਰ ਰਹੀ ਆ ਅਤੇ ਇਹ ਸਾਡੇ ਪੰਜਾਬੀਆਂ ਦੀ ਸਿਹਤ ਲਈ ਬਹੁਤ ਹੀ ਉੱਚ ਕੰਮ ਕਰਦੀ ਹੈ ਸਾਡੇ ਪੰਜਾਬ ਦੇ ਜਿਹੜੇ ਸਿਹਤ ਮੰਤਰੀ ਨੇ ਬਲਬੀਰ ਸਿੰਘ ਉਹਨਾਂ ਨੇ ਵੀ ਪੰਜਾਬ ਦੀ ਸਿਹਤ ਲਈ ਬਹੁਤ ਵਧੀਆ ਕੰਮ ਕੀਤੇ ਨੇ ਅਤੇ ਉਹਨਾਂ ਨੇ ਅਜੇ ਕਈ ਪ੍ਰੋਗਰਾਮ ਉਪਲਬਧ ਕੀਤੇ ਨੇ ਜਿਨ੍ਹਾਂ ਨਾਲ ਪੰਜਾਬੀਆਂ ਦੀ ਸਿਹਤ ਵਿੱਚ ਹੋਰ ਨਿਖਾਰ ਆਵੇ ਜਿਵੇਂ ਹਰ ਬੱਚਾ ਜਿਹੜਾ ਸੱਤ ਸਾਲ ਤੋਂ ਥੱਲੇ ਆ ਉਹਨੂੰ ਹਰ ਤਿੰਨ ਮਹੀਨੇ ਬਾਅਦ ਪੋਲੀਓ ਦੀ ਦਵਾਈ ਟਾਈਮ ਟੂ ਟਾਈਮ ਦੁਆਈ ਜਾਂਦੀ ਆ ਅਤੇ ਉਹਨਾਂ ਦੀ ਸਿਹਤ ਦਾ ਖਿਆਲ ਰੱਖਿਆ ਜਾਂਦਾ ਹੈ ਸਾਡੇ ਪੰਜਾਬ ਦੇ ਵਿੱਚ ਹਰ ਬੰਦਾ ਜਿਹੜਾ ਕਿਸੇ ਵੀ ਬਿਮਾਰੀ ਤੋਂ ਗੁਜ਼ਰ ਰਿਹਾ ਹੈ ਉਹਦੀ ਸਿਹਤ ਲਈ ਆਯੁਸ਼ਮਾਨ ਕਾਰਡ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਹੋਰ ਵੀ ਬਥੇਰੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਪੰਜਾਬ ਦੇ ਵਿੱਚ ਸਿਹਤ ਸੰਭਾਲ ਨੂੰ ਸਾਂਭ ਕੇ ਰੱਖਦੀ ਹੈ ਜਿਵੇਂ ਕਰੋਨਾ ਦੇ ਸਮੇਂ ਹਰ ਪੰਜਾਬੀਆਂ ਦੀ ਸਿਹਤ ਦਾ ਬਹੁਤ ਖਾਸ ਧਿਆਨ ਰੱਖਿਆ ਗਿਆ ਹੈ ਅਤੇ ਹਰ ਪੰਜਾਬੀ ਦਾ ਟੀਕਾਕਰਨ ਸਮੇਂ ਸਿਰ ਹੋਇਆ ਹੈ ਉਸ ਨੂੰ ਵੈਕਸੀਨ ਸਮੇਂ ਸਿਰ ਮਿਲੀ ਹੈ ਇਸ ਤੋਂ ਇਲਾਵਾ ਵੀ ਅਸੀਂ ਟਾਈਮ ਟੂ ਟਾਈਮ ਹਰੇਕ ਚੀਜ਼ ਦਾ ਸੰਭਾਲ ਰੱਖਦੇ ਹਾਂ ਜਿਵੇਂ ਡੇਂਗੂ ਸਮੇਂ ਸਾਡੇ ਪੰਜਾਬੀਆਂ ਨੇ ਇਕੱਠੇ ਹੋ ਕੇ ਅਤੇ ਸਾਡੇ ਸਿਹਤ ਮੰਤਰੀਆਂ ਨੂੰ ਅਤੇ ਸਿਹਤ ਵਿਭਾਗ ਵੱਲੋਂ ਕੰਮ ਕਰਨ ਵਾਲੇ ਡੋਕਟਰਾਂ ਨੇ ਨਰਸਾਂ ਨੇ ਬਹੁਤ ਹੀ ਮਹੱਤਵਪੂਰਨ ਯੋਗਦਾਨ ਨਿਭਾਇਆ ਹੈ ਅਤੇ ਉਹਨਾਂ ਨੇ ਪੰਜਾਬੀਆਂ ਦੀ ਸਿਹਤ ਲਈ ਬਹੁਤ ਹੀ ਵਧੀਆ ਕੰਮ ਕੀਤਾ ਹੈ ਅਤੇ ਅਜਿਹੀਆਂ ਹੋਰ ਬਥੇਰੀਆਂ ਚੀਜ਼ਾਂ ਨੇ ਅਤੇ ਅਜਿਹੀਆਂ ਬਹੁਤ ਸਾਰੀਆਂ ਸਿਹਤ ਸਹੂਲਤਾਂ ਨੇ ਜਿਹੜੇ ਸਾਡੇ ਪੰਜਾਬੀਆਂ ਨੂੰ ਪਰਵਾ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਅਤੇ ਇਸ ਤੋਂ ਇਲਾਵਾ ਵੀ ਸਰਕਾਰ ਪੰਜਾਬ ਸਰਕਾਰ ਸਾਡੀ ਸਿਹਤ ਲਈ ਬਹੁਤ ਵਧੀਆ ਕੰਮ ਕਰ ਰਹੀ ਆ ਅਤੇ ਜਿਹੜੀ ਸਾਡੀ ਸਿਹਤ ਵਿਭਾਗ ਸੰਭਾਲ ਟੈਕਨੋਲਜੀ ਹੈ ਉਹ ਵੀ ਬਹੁਤ ਵਧੀਆ ਕੰਮ ਕਰ ਰਹੀ ਹੈ ਅਤੇ ਉਹਦੀ ਜਿਹੜੀ ਪਦਵੀ ਹੈ ਉਹ ਬਹੁਤ ਹੀ ਉੱਚ ਸਥਾਨ 'ਤੇ ਹੈ